ਹਾਂਜੀ ਕਮਲ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਮੋਹਾਲੀ ਜ਼ਿਲ੍ਹੇ ਦੇ ਅੰਦਰ ਮੈਨੂੰ ਇਹ ਦੱਸੀਂ ਕਿ ਕਿਹੜੇ ਰੈਸਟੋਰੈਂਟ ਜਾਂ ਹੋਟਲ ਦੇ ਉੱਤੇ ਵਧੀਆ ਖਾਣਾ ਮਿਲ ਸਕਦਾ ਜਿਹਦੀ ਗੁਣਵੰਤਾ ਵੀ ਵਧੀਆ ਹੋਵੇ ਅ ਕੁਆਲਿਟੀ ਵੀ ਬਹੁਤ ਵਧੀਆ ਹੋਵੇ ਅਤੇ ਰੇਟ ਵੀ ਸਸਤਾ ਹੋਵੇ ਸਮੇਂ ਸਿਰ ਉਹ ਜਿਹੜਾ ਖਾਣਾ ਏ ਆਪਾਂ ਨੂੰ ਪੁੱਜਦਾ ਕਰ ਦੇਵੇ ਇਸ ਕਰਕੇ ਉਹਨਾਂ ਦੇ ਮੈਨੂੰ ਲੋੜ ਹੈ